ਪੰਜਾਬ ਵਿੱਚ ਮਨੋਰੰਜਨ ਦੇ ਸਭ ਤੋਂ ਪ੍ਰਸਿੱਧ ਰੂਪ ਹਨ ਪੰਜਾਬੀ ਨਾਟਕ ਅਤੇ ਮੂਵੀਆਂ ਪੰਜਾਬੀ ਨਾਟਕ ਅਤੇ ਮੂਵੀਆਂ ਦੇਖਣ ਵਿੱਚ ਦੇਖਣ ਲਈ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਇੱਕੋ ਟਾਈਮ 'ਤੇ ਅਤੇ ਰਲ ਮਿਲ ਕੇ ਸ਼ੋ ਦੇਖਦੇ ਹਨ ਅਤੇ ਉਸ ਵਿੱਚ ਸਾਰੇ ਖਪ ਖੱਪ ਖਾਨਾ ਕਰਦੇ ਹਨ ਪੰਜਾਬੀ ਨਾਟਕ ਜਾਂ ਫਿਰ ਜਦੋਂ ਕੋਈ ਵੀ ਸਪੋਰਟਸ ਦਾ ਮੈਚ ਹੋਵੇ ਉਦੋਂ ਸਾਰੇ ਇਕੱਠੇ ਹੁੰਦੇ ਹਨ ਜਿਸ ਵਿੱਚ ਸਾਰਾ ਪਰਿਵਾਰ ਖੁਸ਼ ਹੁੰਦਾ ਹੈ ਉਹ ਸਾਰੇ ਰਲ ਮਿਲ ਕੇ ਖਾਣਾ ਵਗੈਰਾ ਬਣਾਉਂਦੇ ਹਨ ਖਾਣਾ ਖਾਂਦੇ ਹਨ ਅਤੇ ਬਹੁਤ ਜ਼ਿਆਦਾ ਮਸਤੀ ਕਰਦੇ ਹਨ ਇਸ ਕਰਕੇ ਪੰਜਾਬ ਦਾ ਮਨੋਰੰਜਨ ਦਾ ਪ੍ਰਸਿੱਧ ਰੂਪ ਹੈ ਪੰਜਾਬੀ ਨਾਟਕ ਅਤੇ ਖੇਲ